ਅੱਜ ਕੱਲ੍ਹ ਦੇ ਬੱਚੇ ਬਹੁਤ ਸਾਰੀਆਂ ਹੀ ਨਵੀਆਂ ਖੇਡਾਂ ਖੇਡਦੇ ਹਨ ਪਰ ਜ਼ਿਆਦਾਤਰ ਬੱਚਿਆਂ ਨੂੰ ਮੋਬਾਈਲ ਵਿੱਚ ਖੇਡਣਾ ਹੀ ਪਸੰਦ ਹੁੰਦਾ ਹੈ ਕਈ ਬੱਚੇ ਤਾਂ ਬਾਹਰ ਗਰਾਊਂਡ ਵਿੱਚ ਜਾ ਕੇ ਵੀ ਖੇਡਦੇ ਹਨ ਜਿਵੇਂ ਕਿ ਇਹ ਬੈ ਬੈਕ ਬੋਲ ਅਤੇ ਹੋਰ ਵੀ ਫੁੱਟਬੋਲ ਆਦਿ ਵਰਗੀਆਂ ਗੇਮਾਂ ਕਈ ਮੁੰਡੇ ਹਜੇ ਵੀ ਜਾ ਕੇ ਖੇਡਦੇ ਹਨ ਪਰ ਅੱਜ ਕੱਲ੍ਹ ਦੇ ਬੱਚਿਆਂ ਨੂੰ ਮੋਬਾਈਲ ਵਿੱਚ ਹੀ ਬਹੁਤ ਸਾਰੀਆਂ ਗੇਮਾਂ ਖੇਡਣੀਆਂ ਪਸੰਦ ਹਨ ਕਈ ਸਾਰੀਆਂ ਗੇਮਾਂ ਅੱਜ ਕੱਲ੍ਹ ਮੋਬਾਈਲ ਵਿੱਚ ਹੀ ਆ ਗਈਆਂ ਹਨ ਜੋ ਕਿ ਮੁੰਡਿਆਂ ਨੂੰ ਬਹੁਤ ਜ਼ਿਆਦਾ ਖੇਡਣੀਆਂ ਪਸੰਦ ਹਨ ਜਿਵੇਂ ਕਿ ਪਬਜੀ ਫਾਏ ਫਰੀ ਫਾਇਰ ਆਦਿ ਇਹੋ ਜਿਹੀਆਂ ਗੇਮਾਂ ਹੀ ਅੱਜ ਕੱਲ੍ਹ ਦੇ ਮੁੰਡੇ ਜਾਂ ਬੱਚੇ ਹਰ ਤਰ੍ਹਾਂ ਦੇ ਲੋਕ ਖੇਲਦੇ ਹਨ ਅੱਜ ਕੱਲ੍ਹ ਦੇ ਬੱਚਿਆਂ ਨੂੰ ਬਾਹਰ ਜਾ ਕੇ ਖੇਡਣਾ ਬਿਲਕੁਲ ਵੀ ਪਸੰਦ ਨਹੀਂ ਹੈ ਉਹ ਸਭ ਫੋਨ 'ਤੇ ਹੀ ਗੇਮਾਂ ਖੇਡਦੇ ਹਨ ਨਵੀਆਂ ਨਵੀਆਂ ਗੇਮਾਂ ਕਈ ਹੀ ਲੋਕ ਖੇਡਦੇ ਹਨ ਪ ਪਿੰਡਾਂ ਦੇ ਕਈ ਮੁੰਡੇ ਹਜੇ ਵੀ ਬਾਹਰ ਜਾ ਕੇ ਬੈਟ ਬੋਲ ਅਤੇ ਫੁੱਟਬਾਲ ਆਦਿ ਬਾਸਕਿਟਬੋਲ ਆਦਿ ਖੇਡਦੇ ਹਨ ਜੋ ਕਿ ਉਹਨਾਂ ਨੂੰ ਬਹੁਤ ਪਸੰਦ ਹੁੰਦੀਆਂ ਹਨ ਨਵੀਆਂ ਖੇਡਾਂ ਵਿੱਚ ਤਾਂ ਅੱਜ ਕੱਲ੍ਹ ਮੁੰਡੇ ਮੋਬਾਈਲ ਵਿੱਚ ਹੀ ਜ਼ਿਆਦਾ ਗੇਮਾਂ ਖੇਡਦੇ ਹਨ ਜਿਹਨਾਂ ਨਾਲ ਉਹਨਾਂ ਦੀਆਂ ਕਈ ਤਰ੍ਹਾਂ ਦੀਆਂ ਉਹਨਾਂ ਨੂੰ ਬਿਮਾਰੀਆਂ ਵੀ ਲੱਗ ਜਾਂਦੀਆਂ ਹਨ ਜੋ ਕਿ ਬਹੁਤ ਮਾੜੇ ਕੰਮ ਹੈ ਅੱਜ ਕੱਲ੍ਹ ਦੇ ਬੱਚਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਬਾਹਰ ਜਾ ਕੇ ਖੇਡਣਾ ਹੀ ਬਿਲਕੁਲ ਸਹੀ ਅਤੇ ਸੁਰਕਸ਼ਿਤ ਹੈ ਮੋਬਾਇਲ ਵਿੱਚ ਜ਼ਿਆਦਾਤਰ ਗੇਮਾਂ ਨਹੀਂ ਖੇਡਣੀਆਂ ਚਾਹੀਦੀਆਂ